ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗਾਇਕੀ ਦੀ ਤਕਨੀਕ ਦਾ ਅਭਿਆਸ ਮੈਂ ਹਰ ਰੋਜ਼ ਕਰਦਾ ਹਾਂ ਜਾਨੀ ਕਿ ਸਵੇਰੇ ਚਾਰ ਵਜੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਨਹਾ ਧੋ ਕੇ ਸਿੰ ਆਪਣੀ ਗਾਇਕੀ ਦੇ ਰਿਆਜ਼ ਵਾਸਤੇ ਬੈਠਦਾ ਹਾਂ ਸਭ ਤੋਂ ਪਹਿਲਾਂ ਮੈਂ ਸਾਹ ਦਾ ਰਿਆਜ਼ ਕਰਦਾ ਹਾਂ ਕਿਉਂਕਿ ਸਾਹ ਦਾ ਰਿਆਜ਼ ਹੀ ਸਭ ਤੋਂ ਮਹੱਤਵਪੂਰਨ ਰਿਆਜ਼ ਹੈ ਅਤੇ ਸਭ ਤੋਂ ਜ਼ਰੂਰੀ ਰਾ ਰਿਆਜ਼ ਇਹ ਸਾਹ ਦਾ ਹੀ ਦੱਸਿਆ ਗਿਆ ਹੈ ਸਾਹ ਲਾਉਣ ਤੋਂ ਬਾਅਦ ਹੀ ਆਪਾਂ ਹੋਰ ਸਰਗਮਾ ਦਾ ਰਿਆਜ਼ ਕਰ ਕਰਦੇ ਹਾਂ ਸਾਹ ਲਾਉਣ ਦੇ ਬਹੁਤ ਸਾਰੇ ਫ਼ਾਇਦੇ ਹਨ ਕਿ ਇਹ ਸਭ ਤੋਂ ਪਹਿਲਾਂ ਆਪਣਾ ਗਲਾ ਖੋਲ੍ਹਦਾ ਹੈ ਆਪਣੀ ਆਵਾਜ਼ ਖੋਲ੍ਹਦਾ ਹੈ ਜਾਨੀ ਕਿ ਇਹ ਹੁਣ ਜਿੱਦਾਂ ਕਿ ਮੈਂ ਕਿਸੇ ਪ੍ਰੋਗਰਾਮ 'ਤੇ ਵੀ ਗਾਉਣਾ ਹੈ ਸਭ ਤੋਂ ਪਹਿਲਾਂ ਮੈਨੂੰ ਰਿਆਜ਼ ਦੀ ਲੋੜ ਹੈ ਮੈਂ ਆਪਣੇ ਰਿਆਜ਼ ਦੀ ਤਕਨੀਕ ਦਾ ਅਭਿਆਸ ਹਰ ਰੋਜ਼ ਕਰਦਾ ਹਾਂ ਤਾਂ ਜੋ ਮੇਰੇ ਗਲੇ ਵਿੱਚ ਗਲੇ ਵਿੱਚ ਰਿਆਜ਼ੀ ਬਣੀ ਰਹੇ ਮੈਂ ਆਪਣੇ ਰਿਆਜ਼ ਵਿੱਚ ਹਰ ਰੋਜ਼ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਮੈਂ ਪੁਰਾਣਾ ਅਭਿਆਸ ਵੀ ਜ਼ਰੂਰ ਕਰਦਾ ਹਾਂ ਸਭ ਤੋਂ ਪਹਿਲਾਂ ਸਾਹ ਲਾਉਣਾ ਅਤੇ ਫਿਰ ਉਸ ਤੋਂ ਬਾਅਦ ਸਰਗਮਾਲ ਦਾ ਅਭਿਆਸ ਕਰਨਾ

ਸਭ ਤੋਂ ਪਹਿਲਾਂ ਸਾਹ ਲਾ ਕੇ ਸਰਗਮਾ ਦਾ ਰਿਆਜ਼ ਕਰਕੇ ਫਿਰ ਜੋ ਵੀ ਰਾਗਾਂ ਦੀ ਮੈਂ ਪੇਸ਼ਕਾਰੀ ਕਰਨੀ ਹੁੰਦੀ ਹੈ ਉਸ ਦਾ ਅਭਿਆਸ ਕਰਦਾ ਹਾਂ ਜਾਨੀ ਕਿ ਗਾਇਕੀ ਦੇ ਵਿੱਚ ਬਹੁਤ ਸਾਰੇ ਰਾਗ ਹਨ ਯਾਨੀ ਕਿ ਭੈਰਵੀ ਭੈਰਵ ਬਿਲਾਵਲ ਯਮਨ ਬਹੁਤ ਸਾਰੇ ਹੋਰ ਵੀ ਰਾਗ ਹਨ ਬਹੁਤ ਸਾਰੇ ਹੋਰ ਵੀ ਰਾਗ ਹਨ ਅਤੇ ਕੁਝ ਰਾਗ ਉਹਨਾਂ ਵਿੱਚ ਬਹੁਤ ਮੁਸ਼ਕਿਲ ਹਨ ਇਸ ਤਰ੍ਹਾਂ ਨਹੀਂ ਹੈ ਵੀ ਹਰ ਇੱਕ ਰਾਗ ਹੀ ਬਹੁਤ ਆਸਾਨ ਹੈ ਪਰ ਵਾਰ ਵਾਰ ਰਿਆਜ਼ ਕਰਕੇ ਆਪਾਂ ਉਸ ਮੁਸ਼ਕਲ ਰਾਗ ਨੂੰ ਵੀ ਆਸਾਨ ਬਣਾ ਸਕਦੇ ਹਾਂ ਮੈਂ ਆਪਣਾ ਰਿਆਜ਼ ਸਵੇਰੇ ਚਾਰ ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤੱਕ ਕਰਦਾ ਹਾਂ ਉਸ ਤੋਂ ਬਾਅਦ ਨਾਸ਼ਤਾ ਕਰਕੇ ਮੈਂ ਫਿਰ ਦਸ ਵਜੇ ਰਿਆਜ਼ 'ਤੇ ਬੈਠ ਜਾਂਦਾ ਹਾਂ ਫਿਰ ਮੈਂ ਦੋ ਵਜੇ ਉੱਠਦਾ ਹਾਂ ਅਤੇ ਰਾਤ ਨੂੰ ਵੀ ਮੈਂ ਚਾਰ ਪੰਜ ਘੰਟੇ ਰਿਆਜ਼ ਜ਼ਰੂਰ ਕਰਦਾ ਹਾਂ ਅਤੇ ਕੁਝ ਕੁ ਰਾਗ ਹਨ ਜੋ ਕਿ ਮੈਨੂੰ ਮੁਸ਼ਕਿਲ ਲੱਗਦੇ ਹਨ ਅਤੇ ਉਹਨਾਂ ਦੀ ਮੈਂ ਅਭਿਆਸਨਕ ਹਰ ਰੋਜ਼ ਕਰਦਾ ਹਨ ਬਸ ਠੀਕ ਹੈ ਜੀ ਧੰਨਵਾਦ